ਯੋਗਾ ਕਰਨ ਨਾਲ ਮਨੁੱਖ ਦਾ ਸਰੀਰ ਕਦੇ ਦਿਮਾਗੀ ਤੌਰ 'ਤੇ ਤਣਾਉ ਘੱਟਦਾ ਹੈ ਅਤੇ ਸਦਾ ਸੁਭਾਅ ਵੀ ਸ਼ਾਂਤਮਈ ਹੋ ਜਾਂਦਾ ਹੈ ਜਿਸ ਨਾਲ ਕਿ ਉਸਨੂੰ ਸ ਸੋਚਣ ਸ਼ਕਤੀ ਅਤੇ ਸਹਿਣ ਸ਼ਕਤੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਅਤੇ ਉਸਨੂੰ ਬਿਮਾਰੀਆਂ ਨਾਲ ਲੜਨ ਦਾ ਵੀ ਸ਼ਕਤੀ ਵੱਧ ਜਾਂਦੀ ਹੈ ਇਸ ਲਈ ਯੋਗਾ ਦਾ ਸਾਡੇ ਸਰੀਰਕ ਰੂਪ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਅਤੇ ਇਹ ਸਾਡੇ ਦਿਮਾਗੀ ਤਣਾਉ ਨੂੰ ਵੀ ਘਟਾਉਂਦੀ ਹੈ ਜਿਸ ਨਾਲ ਕਿ ਮਨੁੱਖ ਸ਼ਾਂਤ ਰਹਿਣਾ ਸਿੱਖ ਜਾਂਦਾ